ਮੈਂ ਆਪਣੀ ਰਚਨਾ ਦੇ ਵਿੱਚ ਕਿਰਦਾਰਾਂ ਦਾ ਜਿਹੜਾ ਵਿਕਾਸ ਆ ਉਹ ਸਮਾਜ ਵਿੱਚੋਂ ਲੈ ਕੇ ਹੀ ਕਰਦਾ ਸਮਾਜ ਦੇ ਵਿੱਚ ਕਿਰਦਾਰਾਂ ਨੂੰ ਵੇਖਦਾ ਯਥਾਰਥਵਾਦੀ ਢੰਗ ਦੇ ਨਾਲ ਹੂਬਹੂ ਉਹਨਾਂ ਨੂੰ ਮੈਂ ਰਚਨਾ ਵਿੱਚ ਢਾਲਣ ਦੀ ਹੈ ਜਿਹੜੀ ਉਹ ਕੋਸ਼ਿਸ਼ ਕਰਦਾ ਇਹਦੇ ਨਾਲ ਜਿਹੜੇ ਕਿਰਦਾਰ ਆ ਉਹ ਤੁਹਾਨੂੰ ਬਿਲਕੁਲ ਔਰਿਜਨਲ ਜਿਹੜੇ ਲੱਗਦੇ ਨੇ ਉਹਨਾਂ ਦੀ ਬੋਲੀ ਉਹਨਾਂ ਦੀ ਬੋਡੀ ਲੈਂਗੁਏਜ ਮੈਂ ਆਪਣੀਆਂ ਰਚਨਾਵਾਂ ਦੇ ਵਿੱਚ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦਾ ਮੇਰੀ ਰਚਨਾ ਦੇ ਵਿੱਚ ਜਿਹੜੇ ਮੇਰੇ ਕੋਲ ਭਰੋਸੇਯੋਗ ਅਤੇ ਦਿਲਚਸਪ ਅੱਖਰ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਮੇਰਾ ਭਾਸ਼ਾ ਦੇ ਨਾਲ ਜੁੜਿਆ ਹੋਣਾ ਹੀ ਹੈ ਖੇਤਰੀ ਭਾਸ਼ਾ ਦੇ ਵਿੱਚ ਮੈਂ ਪੁਰਾਣੇ ਬਜ਼ੁਰਗਾਂ ਨੂੰ ਮੈਂ ਆਪਦੇ ਪਰਿਵਾਰ ਨੂੰ ਆਂਢ ਗੁਆਂਢ ਨੂੰ ਅਲੱਗ ਅਲੱਗ ਕਿੱਤੇ ਕਾਰਾਂ ਦੇ ਲੋਕਾਂ ਨੂੰ ਅਲੱਗ ਅਲੱਗ ਸੁਭਾਅ ਦੇ ਲੋਕਾਂ ਨੂੰ ਜਦੋਂ ਅਲੱਗ ਅਲੱਗ ਪ੍ਰਸਥਿਤੀਆਂ ਦੇ ਵਿੱਚ ਬੋਲਦਾ ਵੇਖਦਾ ਹਾਂ ਤਾਂ ਮੈਂ ਉਹਨਾਂ ਨੂੰ ਨੋਟਿਸ ਕਰਦਾ ਹਾਂ ਜਿਹੜੇ ਵੀ ਸ਼ਬਦ ਜਾਂ ਅੱਖਰ ਉਹਨਾਂ ਵੱਲੋਂ ਬੋਲੇ ਜਾਂਦੇ ਹਨ ਉਹਨਾਂ ਨੂੰ ਮੈਂ ਬੇਹੱਦ ਧਿਆਨ ਦੇ ਨਾਲ ਸੁਣਦਾ ਹਾਂ ਉਹੀ ਬੋਲ ਉਹੀ ਸ਼ਬਦ ਮੈਂ ਆਪਦੇ ਪਾਤਰਾਂ ਦੇ ਕੋਲੋਂ ਬੁਲਵਾਉਂਦਾ ਹਾਂ ਸਮਾਜ ਅਤੇ ਮਨੁੱਖਾਂ ਬਾਰੇ ਅਸਲ ਅਪਮਾਨਜਨਕ ਗੱਲਾਂ ਮੈਂ ਲਿੱਖਦਾ ਇਹਨਾਂ ਨੂੰ ਲਿਖਣ ਵੇਲੇ ਮੈਨੂੰ ਇਹ ਲੱਗਦਾ ਹੁੰਦਾ ਮੈਂ ਇਹ ਇਹ ਗੱਲਾਂ ਮੈਂ ਤਾਂ ਲਿਖਦਾ ਕਿਉਂਕਿ ਸਾਹਿਤ ਆ ਜਿਹੜਾ ਸਮਾਜ ਦਾ ਸ਼ੀਸ਼ਾ ਅਤੇ ਇਹ ਸਾਹਿਤ ਦੇ ਵਿੱਚ ਦਿਖਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਧੰਨਵਾਦ